ਪਿਛਲੇ ਹਫ਼ਤੇ ਮੈਨੂੰ ਇੱਕ ਕੋਲੇਜ ਪ੍ਰੋਜੈਕਟ ਮਿਲਿਆ ਜੋ ਕਿ ਬਹੁਤ ਲੰਬਾ ਅਤੇ ਮੁਸ਼ਕਿਲ ਸੀ ਕਿਉਂਕਿ ਮੈਂ ਜ਼ਿਆਦਾਤਰ ਛੋਟੇ ਪੇਂਟਿੰਗ ਪ੍ਰੋਜੈਕਟ ਹੀ ਤਿਆਰ ਕਰਦੀ ਹਾਂ ਪਹਿਲਾਂ ਤਾਂ ਮੈਨੂੰ ਇਸ ਬਾਰੇ ਸੋਚਣ ਵਿੱਚ ਮੁਸ਼ਕਿਲ ਹੋਈ ਕਿ ਮੈਂ ਆਪਣੇ ਸ ਪ੍ਰੋਜੈਕਟ ਨੂੰ ਕਿੰਝ ਕੰਪਲੀਟ ਕਰਾਂਗੀ ਅਤੇ ਇਸ ਦੀ ਸ਼ੁਰੂਆਤ ਕਿਵੇਂ ਕਰਾਂਗੀ ਫਿਰ ਮੈਂ ਆਪਣੇ ਸੰਬੰਧਿਤ ਟੀਚਰ ਨੂੰ ਮਿਲੀ ਉਹਨਾਂ ਨੇ ਮੈਨੂੰ ਸਮਝਾਇਆ ਅਤੇ ਮੈਨੂੰ ਉਤਸ਼ਾਹਿਤ ਕਰਦਿਆਂ ਹੋਏ ਮੇਰੇ ਪ੍ਰੋਜੈਕਟ ਨਾਲ ਸੰਬੰਧਿਤ ਕੁਝ ਉਦਾਹਰਨਾਂ ਦਿੱਤੀਆਂ ਫਿਰ ਮੈਂ ਹੌਲੀ ਹੌਲੀ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਪਰੰਤੂ ਇਹ ਪ੍ਰੋਜੈਕਟ ਤਿਆਰ ਕਰਨ ਵਿੱਚ ਮੈਨੂੰ ਮੁਸ਼ਕਿਲ ਆ ਰਹੀ ਸੀ ਕਿਉਂਕਿ ਮੈਂ ਪਹਿਲੀ ਵਾਰ ਇਹ ਪ੍ਰੋਜੈਕਟ ਕਰ ਰਹੀ ਸਾਂ ਜੋ ਕਿ ਬਹੁਤ ਕਠਿਨ ਅਤੇ ਬਹੁਤ ਲੰਬਾ ਸੀ ਫਿਰ ਮੈਂ ਆਪਣੇ ਫਰੈਂਡਸ ਦੀ ਸਹਾਇਤਾ ਲਈ ਮੈਂ ਉਹਨਾਂ ਨੂੰ ਆਪਣੇ ਪ੍ਰੋਜੈਕਟ ਨਾਲ ਸੰਬੰਧਿਤ ਮੁਸ਼ਕਿਲਾਂ ਦੱਸੀਆਂ ਉਹਨਾਂ ਨੇ ਮੇਰੀ ਕਲਾ ਨੂੰ ਉਤਸ਼ਾਹਿਤ ਕਰਦੇ ਹੋਏ ਮੈਨੂੰ ਮੋਟੀਵੇਟ ਕੀਤਾ ਅਤੇ ਮੇਰੀ ਸਹਾਇਤਾ ਕੀਤੀ ਇਸ ਨਾਲ ਮੈਨੂੰ ਬਹੁਤ ਕੋਨਫੀਡੈਂਸ ਮਿਲਿਆ ਅਤੇ ਮੈਂ ਆਪਣਾ ਪ੍ਰੋਜੈਕਟ ਜ਼ਾਰੀ ਰੱਖਿਆ ਮੈਂ ਆਪਣਾ ਇਹ ਪ੍ਰੋਜੈਕਟ ਛੇ ਦਿਨਾਂ ਵਿੱਚ ਤਿਆਰ ਕੀਤਾ ਅਤੇ ਤਿਆਰ ਕਰਨ ਤੋਂ ਬਾਅਦ ਮੈਂ ਇਹ ਪ੍ਰੋਜੈਕਟ ਆਪਣੇ ਸਾਰੇ ਫਰੈਂਡਸ ਅਤੇ ਸਬੰਧਿਤ ਟੀਚਰ ਨੂੰ ਦਿਖਾਇਆ ਸਭ ਨੇ ਮੇਰੇ ਪ੍ਰੋਜੈਕਟ ਦੀ ਬਹੁਤ ਤਾਰੀਫ਼ ਕੀਤੀ ਜਿਸ ਨਾਲ ਮੈਨੂੰ ਹੋਰ ਕੋਨਫੀਡੈਂਸ ਵੀ ਮਿਲਿਆ ਅਤੇ ਮੈਂ ਅੱਗੇ ਤੋਂ ਇਹੋ ਜਿਹੇ ਹੋਰ ਪ੍ਰੋਜੈਕਟ ਤਿਆਰ ਕਰਨ ਲਈ ਮੋਟੀਵੇਟ ਵੀ ਹੋਈ ਮੈਂ ਆਪਣੇ ਟੀਚਰਸ ਅਤੇ ਫਰੈਂਡਸ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਮੈਨੂੰ ਇੰਨਾ ਉਤਸ਼ਾਹਿਤ ਕਰਕੇ ਮੇਰਾ ਪ੍ਰੋਜੈਕਟ ਕੰਪਲੀਟ ਕਰਨ ਵਿੱਚ ਮੇਰੀ ਬਹੁਤ ਸਹਾਇਤਾ ਕੀਤੀ ਇਸ ਤਰ੍ਹਾਂ ਮੈਨੂੰ ਮੇਰੇ ਪ੍ਰੋਜੈਕਟ ਨੂੰ ਤਿਆਰ ਕਰਦੇ ਸਮੇਂ ਪ੍ਰੇਰਣਾ ਮਿਲਦੀ ਗਈ ਅਤੇ ਮੈਂ ਆਪਣਾ ਪ੍ਰੋਜੈਕਟ ਕੰਪਲੀਟ ਕਰ ਲਿਆ ਸਭ ਤੋਂ ਵੱਡੀ ਗੱਲ ਕਿ ਸਾਨੂੰ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਜੇਕਰ ਸਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਾਨੂੰ ਕਿਸੇ ਨਾਲ ਸੁਲਝਾ ਲੈਣੀ ਚਾਹੀਦੀ ਹੈ ਕਿਸੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਪ੍ਰੋਜੈਕਟ ਆਪਣੇ ਉਸ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ ਸਕੀਏ ਧੰਨਵਾਦ